ਜੀ ਹਾਂ ਅਸੀਂ ਸ਼ਹਿਰ ਵਿੱਚ ਰਹਿੰਦੇ ਹਾਂ ਇਸ ਕਰਕੇ ਸਾਡੀ ਕਾਰਪੋਰੇਸ਼ਨ ਸਾਨੂੰ ਦਿਨ ਵਿੱਚ ਤਿੰਨ ਟਾਈਮ ਸਮੇਂ ਦੇ ਹਿਸਾਬ ਦੇ ਨਾਲ ਪਾਣੀ ਦੀ ਸਪਲਾਈ ਦਿੰਦੀ ਹੈ ਜੇ ਆਹ ਅਸੀਂ ਦੇਖੀਏ ਤਾਂ ਪਿੰਡਾਂ ਦੇ ਵਿੱਚ ਜਿੱਥੇ ਜਦੋਂ ਲੋਕੀ ਖੂਹਾਂ ਦੇ ਵਿੱਚੋਂ ਪਾਣੀ ਭਰਦੇ ਸੀ ਤਾਂ ਅੱਜ ਅਸੀਂ ਟੂਟੀ ਦੀ ਵਰਤੋਂ ਦੇ ਨਾਲ ਪਾਣੀ ਦਾ ਜੋ ਹੈ ਉਹ ਪ੍ਰਯੋਗ ਕਰਦੇ ਹਾਂ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡਾ ਜੀਵਨ ਜੋ ਹੈ ਉਹ ਕਿੰਨਾ ਆਸਾਨ ਹੋ ਗਿਆ ਹੈ ਨਹੀਂ ਤਾਂ ਪਹਿਲਾਂ ਜੋ ਇਸਤਰੀਆ ਸੀ ਘਰ ਦੀਆਂ ਉਹ ਘੜੇ ਲੈ ਕੇ ਪਾਣੀ ਭਰਨ ਵਾਸਤੇ ਪਿੰਡ ਦੇ ਖੂਹ 'ਤੇ ਜਾਂਦੀਆਂ ਸਨ ਉੱਥੋਂ ਦੀ ਪਾਣੀ ਭਰ ਕੇ ਸਿਰ 'ਤੇ ਲੱਦ ਕੇ ਅਤੇ ਉਹ ਪਾਣੀ ਘਰ ਲਿਆ ਕੇ ਫਿਰ ਉਸ ਪਾਣੀ ਨੂੰ ਵਰਤ ਕੇ ਆਪਣੇ ਰੋਜ਼ਮੱਰਾ ਦੇ ਕੰਮ ਕਰਦੀਆਂ ਸਨ ਪਰ ਜੇ ਜਦੋਂ ਹੁਣ ਟੂਟੀ ਰਾਹੀਂ ਸਾਨੂੰ ਪਾਣੀ ਜੋ ਹੈ ਘਰ ਬੈਠੇ ਮਿਲਦਾ ਹੈ ਤਾਂ ਸਾਡਾ ਜੀਵਨ ਤਾਂ ਆਸਾਨ ਹੋ ਹੀ ਗਿਆ ਹੈ ਪਰ ਜੇ ਅਸੀਂ ਦੇਖੀਏ ਕਿ ਇਹ ਪਾਣੀ ਸਾਫ ਹੈ ਤਾਂ ਥੋੜ੍ਹਾ ਜਿਹਾ ਦੁੱਖ ਹੁੰਦਾ ਹੈ ਕਿਉਂਕਿ ਪਾਣੀ ਪਹਿਲਾਂ ਸਾਫ ਸੀ ਪਰ ਜਿਸ ਤਰ੍ਹਾਂ ਜਿਸ ਜਿਸ ਤਰ੍ਹਾਂ ਜੋ ਹੈ ਇੰਡਸਟਰੀਆਂ ਵੱਧਦੀਆਂ ਜਾ ਰਹੀਆਂ ਹਨ ਅਤੇ ਗੰਦਗੀ ਵੱਧਦੀ ਜਾ ਰਹੀ ਹੈ ਤਾਂ ਪਾਣੀ ਸਾਨੂੰ ਉੱਨਾ ਸਾਫ ਨਹੀਂ ਮਿਲ ਰਿਹਾ ਜਿੰਨਾ ਪਹਿਲਾਂ ਮਿਲ ਰਿਹਾ ਸੀ